ਹਾਂਜੀ ਮੈਂ ਤੁਹਾਨੂੰ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦੀ ਹਾਂ ਭੰਗੜਾ ਆਪਣੇ ਦੇਸ਼ ਦੀ ਸ਼ਾਨ ਹੈ ਭੰਗੜਾ ਭੰਗੜੇ ਦੇ ਨਾਲ ਆਪਣੇ ਪੰਜਾਬ ਦੀ ਸ਼ਾਨ ਵੱਧਦੀ ਹੈ ਇਸਨੂੰ ਪੰ ਮੁੰਡੇ ਅਤੇ ਕੁੜੀਆਂ ਦੋਨੋਂ ਕਰਦੇ ਹਨ ਇਹ ਆਪਣੇ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਹੋਰ ਸਾਰੇ ਕਈ ਰਾਜਾਂ ਵਿੱਚ ਵੀ ਕਰਵਾਇਆ ਜਾਂਦਾ ਹੈ ਇਸ ਨੂੰ ਵਿਆਹਾਂ ਸ਼ਾਦੀਆਂ ਵਿੱਚ ਵੀ ਕਰਵਾਇਆ ਜਾਂਦਾ ਹੈ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਕਰ ਸਕਦੇ ਹਨ ਇਸ ਵਿੱਚ ਮੁੰਡੇ ਅਤੇ ਕੁੜੀਆਂ ਦੋਨੋਂ ਮੁੰਡੇ ਕੁੜਤਾ ਪਜਾਮਾ ਪਾ ਕੇ ਅਤੇ ਕੁੜੀਆਂ ਲਹਿੰਗਾ ਚੋਲੀ ਪਾ ਕੇ ਇਸ ਦੀ ਸ਼ਾਨ ਵਧਾਉਂਦੀਆਂ ਹਨ ਇਸ ਨੂੰ ਵਿਆਹਾਂ ਸ਼ਾਦੀਆਂ ਵਿੱਚ ਹੀ ਨਹੀਂ ਸਕੂਲ ਕਾਲਜਾਂ ਵਿੱਚ ਵੀ ਕਰਵਾਇਆ ਜਾਂਦਾ ਹੈ ਸਕੂਲ ਕਾਲਜਾਂ ਵਿੱਚ ਵੀ ਮੁੰਡੇ ਅਤੇ ਕੁੜੀਆਂ ਮੁੰਡੇ ਕੁੜਤਾ ਪਜ਼ਾਮਾ ਪਾ ਕੇ ਅਤੇ ਕੁੜੀਆਂ ਲਹਿੰਗਾ ਚੋਲੀ ਪਾ ਕੇ ਸਕੂਲਾਂ ਦੇ ਫੰਕਸ਼ਨਾਂ ਦੀ ਰੌਣਕ ਨੂੰ ਵਧਾਉਂਦੇ ਹਨ ਧੰਨਵਾਦ ਜੀ